ਜੇਕਰ ਅਸੀਂ ਹਸਪਤਾਲਾਂ ਦੀ ਗੱਲ ਕਰੀਏ ਤਾਂ ਪੰਜਾਬ ਸਰਕਾਰ ਅੱਜ ਕੱਲ੍ਹ ਚਲੋ ਪਹਿਲਾਂ ਦੀਆਂ ਸਰਕਾਰਾਂ ਤਾਂ ਬਹੁਤ ਮਾੜੀਆਂ ਸਨ ਪਰ ਅੱਜ ਕੱਲ੍ਹ ਜਿਹੜੀਆਂ ਸਰਕਾਰਾਂ ਆਈਆਂ ਹਨ ਉਹ ਵੀ ਚੰਗੀਆਂ ਹਨ ਵਿੱਚ ਵਿੱਚ ਉਹ ਵੀ ਅਣਬਣ ਕਰ ਜਾਂਦੀਆਂ ਹਨ ਪਰ ਇਹਨਾਂ ਦੇ ਜਿਹੜੀ ਕਿ ਸਭ ਤੋਂ ਮਹੱਤਵਪੂਰਨ ਗੱਲ ਹੈ ਕਿ ਸਾਡੇ ਪੰਜਾਬ ਵਿੱਚ ਜਾਂ ਸਾਡੇ ਸ਼ਹਿਰਾਂ ਵਿੱਚ ਹੋਸਪਿਟਲਾਂ ਦੀ ਬਹੁਤ ਜ਼ਿਆਦਾ ਮਾਤਰਾ ਹੋਣੀ ਚਾਹੀਦੀ ਹੈ ਸਰਕਾਰੀ ਹਸਪਤਾਲਾਂ ਦੀ ਤੋ ਇੱਦਾਂ ਹੀ ਹੈ ਸਰਕਾਰੀ ਹੋਸਪਿਟਲ ਵਧੀਆ ਹਨ ਅਤੇ ਇਹਨਾਂ ਵਿੱਚ ਪਹਿਲਾਂ ਨਾਲੋਂ ਵਾਹ ਵਾਹ ਤਰੱਕੀ ਕੀਤੀ ਗਈ ਹੈ ਹੋਸਪਿਟਲਾਂ ਵਿੱਚ ਹਰ ਇੱਕ ਸਰਕਾਰੀ ਸਹੂਲਤ ਜਿਹੜੀ ਕਿ ਸਰਕਾਰ ਵੱਲੋਂ ਲਾਜ਼ਮੀ ਹੈ ਜਾਂ ਜੇ ਜਿਹੜੀ ਉਹਨਾਂ ਦੇ ਪੋਸੀਬਲ ਚੀਜ਼ ਹੈ ਉਹ ਕਰਦੇ ਹਨ ਹਰ ਤਰ੍ਹਾਂ ਦੀਆਂ ਮਸ਼ੀਨਾਂ ਇਹਨਾਂ ਵਿੱਚ ਉਪਲੱਬਧ ਹਨ ਹਰ ਤਰ੍ਹਾਂ ਦੇ ਆਪਰੇ ਆਪਰੇਸ਼ਨ ਕੀਤੇ ਜਾਂਦੇ ਹਨ ਇਹਨਾਂ ਵਿੱਚ ਅਤੇ ਅੱਜ ਕੱਲ੍ਹ ਸਰਕਾਰੀ ਹੋਸਪੀਟਲ ਵੀ ਕਿਸੇ ਪ੍ਰਾਈਵੇਟ ਹੋਸਪੀਟਲ ਨਾਲੋਂ ਘੱਟ ਨਹੀਂ ਹਨ